ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਗੁਰੂ ਨਾਨਕ ਦੇਵ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਭਾਅ ਜੀ ਮੈਂ ਤੁਹਾਨੂੰ ਨਾ ਤੁਹਾਡਾ ਧੰਨਵਾਦ ਕਰਨ ਵਾਸਤੇ ਫੋਨ ਕੀਤਾ ਸੀਗਾ ਹਾਂਜੀ ਰਾਤ ਅਸੀਂ ਕਿਤੇ ਬਾਹਰ ਘੁੰਮਣ ਗਏ ਵੇ ਸੀਗੇ ਪੂਰੀ ਫੁੱਲ ਫੈਮਿਲੀ ਅਤੇ ਰਾਤੀਂ ਅਸੀਂ ਪਿੰਡ ਆਉਣਾ ਸੀਗਾ ਅਤੇ ਅਸੀਂ ਤੁਹਾਡੇ ਇੱਕ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਸੀਗਾ ਅਤੇ ਟੈਕਸੀ ਬੁੱਕ ਕਰਵਾਈ ਸੀਗੀ ਹਾਂਜੀ ਉਹ ਨਾ ਉਹਨਾਂ ਬਾਰੇ ਗੱਲ ਕਰਨੀ ਸੀਗੀ ਉਹ ਬਹੁਤ ਵਧੀਆ ਬੰਦੇ ਨਿਕਲੇ ਨੇ ਉਹਨਾਂ ਨੇ ਸਾਨੂੰ ਵਧੀਆ ਪਿਕ ਕੀਤਾ ਜੀ ਅਤੇ ਵਧੀਆ ਗੱਡੀ ਚਲਾਈ ਹੈ ਇੱਕ ਪ੍ਰਸੈਂਟ ਦੀ ਵੀ ਆਰਾਮ ਨਾਲ ਗੱਡੀ ਲੈ ਕੇ ਆਇਆ ਸਾਨੂੰ ਬਾਣੀ ਸੁਣਾਈ ਆ ਰਾਸਤੇ ਦੇ ਵਿੱਚ ਉਹਨਾਂ ਨੇ ਜੀ ਵਧੀਆ ਸਾਡੇ ਨਾਲ ਉਹ ਘੁਲ ਮਿਲ ਕੇ ਗੱਲ ਕੀਤੀ ਹੈਗੀ ਆ ਜਿੱਥੇ ਸਾਨੂੰ ਸੁਬ ਸੁਬਹਾ ਦੇ ਚਾਰ ਵੱਜਨੇ ਸੀ ਘਰ ਆਉਣ 'ਤੇ ਜੀ ਕਿਉਂਕਿ ਰਾਤ ਨੂੰ ਬੱਸਾਂ ਚੱਲਦੀਆਂ ਨਹੀਂ ਤੁਹਾਨੂੰ ਪਤਾ ਹੀ ਹੈਗਾ ਅਤੇ ਉਹਦੇ ਕਰਕੇ ਉਹਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਹਨੇ ਸਾਡਾ ਦੇਰ ਰਾਤ ਤੱਕ ਸਾਥ ਨਿਭਾਇਆ ਅਤੇ ਸਾਨੂੰ ਸਹੀ ਸਲਾਮਤ ਘਰ ਪਹੁੰਚਦਾ ਕਰਤਾ ਹਾਂਜੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਅਸੀਂ ਉਨ੍ਹਾਂ ਦਾ